ਜੜੀ ਬੂਟੀਆਂ ਸਾਡੇ ਜੀਵਨ ਵਿੱਚ ਇੱਕ ਮਹੱਤਵ ਰੱਖਦੀਆਂ ਹਨ ਆਮ ਤੌਰ 'ਤੇ ਇਹ ਦਵਾਈ ਨਾਲੋਂ ਚੰਗੀਆਂ ਸਾਬਿਤ ਹੁੰਦੀਆਂ ਹਨ ਅਤੇ ਇਸ ਦੇ ਕੋਈ ਸਾਈਡ ਇਫੈਕਟ ਵੀ ਨਹੀਂ ਹੁੰਦੇ ਇਸ ਕਰਕੇ ਜੜੀ ਬੂਟੀਆਂ ਖਾਣਾ ਪਕਾਉਣ ਵਿੱਚ ਵੀ ਇਸਤੇਮਾਲ ਕੀਤੀਆਂ ਜਾਂਦੀਆਂ ਹਨ ਜੜੀ ਬੂਟੀਆਂ ਜਿਵੇਂ ਕਿ ਤੁਲਸੀ ਅਸ਼ਵਗੰਧਾ ਕਾਲੀ ਮਿਰਚ ਤੇਜ ਪੱਤਾ ਪੁਦੀਨਾ ਆਦਿ ਘਰ ਵਿੱਚ ਵੀ ਉਗਾਈਆਂ ਜਾ ਸਕਦੀਆਂ ਹਨ ਅਤੇ ਇਹ ਸਾਡੇ ਸਰੀਰ ਲਈ ਬਹੁਤ ਚੰਗੀ ਹੁੰਦੀ ਹੈ ਤੁਲਸੀ ਜੋ ਹੈ ਜ਼ੁਕਾਮ ਜਾਂ ਫਿਰ ਸਿਰ ਦਰਦ ਵਿੱਚ ਕੰਮ ਆਉਂਦੀ ਹੈ ਇਸ ਨਾਲ ਉਹ ਸਭ ਠੀਕ ਹੋ ਜਾਂਦਾ ਹੈ ਪੁਦੀਨਾ ਸਾਡੇ ਪੇਟ ਵਾਸਤੇ ਬਹੁਤ ਚੰਗਾ ਹੈ ਅਤੇ ਅਸ਼ਵਗੰਧਾ ਤੋਂ ਮੰਨਿਆ ਜਾਂਦਾ ਹੈ ਕਿ ਲੰਬਾਈ ਵੀ ਵੱਧਦੀ ਹੈ ਕਾਲੀ ਮਿਰਚ ਵੀ ਦਿਮਾਗ ਤੇਜ਼ ਕਰਨ ਵਿੱਚ ਬਹੁਤ ਤੇਜ਼ ਹੁੰਦੀ ਹੈ ਇਹ ਇਹਨਾਂ ਵਿੱਚੋਂ ਸਾਰੀ ਦੀ ਸਾਰੀ ਚੀਜ਼ਾਂ ਘਰ ਵਿੱਚ ਵੀ ਉਗਾਈਆਂ ਜਾ ਸਕਦੀਆਂ ਹਨ